ਭਾਰਤ ਵਿੱਚ ਬਹੁਤ ਸਾਰੀਆਂ ਸੱਭਿਆਚਾਰਿਕ ਪ੍ਰੰਪਰਾਵਾਂ ਹਨ ਜਿਵੇਂ ਕੀ ਲੋਕ ਨਾਚ ਹੈ ਜਿਵੇਂ ਸਾਡੇ ਭਾਰਤ ਦਾ ਕਲਚਰ ਹੋ ਗਿਆ ਉਹ ਤੋਂ ਬਾਅਦ ਦਾ ਕਲਚਰ ਉਹ ਬਹੁਤ ਹੀ ਜ਼ਿਆਦਾ ਵੱਖਰਾ ਹੁੰਦਾ ਹੈ ਇੱਥੇ ਦਾ ਪਹਿਰਾਵਾ ਬਿਲਕੁਲ ਅਲੱਗ ਹੈ ਜਿਵੇਂ ਭਾਰਤ ਦੇ ਸੱਭਿਆਚਾਰ ਦਾ ਵੱਖ ਦੇਖਿਆ ਜਾਵੇ ਤਾਂ ਦੋਨਾਂ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹੈਗਾ ਅਤੇ ਇੱਥੇ ਧੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਵੇਂ ਇੱਥੇ ਜੇ ਜਿਹੜੀ ਕੁੜੀ ਦਾ ਵਿਆਹ ਹੋ ਜਾਂਦਾ ਹੈ ਉਹ ਆਉਂਦੀ ਆ ਆਪਣੇ ਘਰ ਅਤੇ ਸਾਰੀ ਸਹੇਲੀਆਂ ਇਕੱਠੀਆਂ ਹੁੰਦੀਆਂ ਪੀਂਘ ਝੂਲਦੀਆਂ ਵਧੀਆ ਵਧੀਆ ਕੱਪੜੇ ਪਹਿਨਦੀਆਂ ਅਤੇ ਇਸ ਤਿਆਰ ਹੁੰਦੀਆਂ ਹੈ ਮਹਿੰਦੀ ਵਗੈਰਾ ਲਗਾਉਂਦੀਆਂ ਹੁੰਦੀਆਂ ਮਤਲਬ ਇਹ ਸਾਰਾ ਤਾਂ ਵਿਆਹੀ ਕੁੜੀਆਂ ਵੀ ਕਰਦੀਆਂ ਅਤੇ ਵਿਆਹ ਤੋਂ ਪਹਿਲੇ ਜਿਹੜੇ ਕੁੜੀਆਂ ਹੁੰਦੀਆਂ ਉਹ ਵੀ ਇਹ ਤਿਉਹਾਰ ਮਨਾਉਂਦੀਆਂ ਹੁੰਦੀਆਂ ਕਿਉਂਕਿ ਇਹ ਧੀਆਂ ਦਾ ਤਿਉਹਾਰ ਹੁੰਦਾ ਹੈ ਅਤੇ ਇਹ ਸਾਵਣ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਇੱਕ ਚੰਗੇ ਵਰ ਲਈਏ ਵੀ ਆਪਾਂ ਇਹ ਤਿਉਹਾਰ ਮਨਾਉਂਦੇ ਹੁੰਦੇ ਹਾਂ ਸਾਰੇ ਕੁੜੀਆਂ ਇਕੱਠੀਆਂ ਹੁੰਦੀਆਂ ਬਹੁਤ ਜ਼ਿਆਦਾ ਹੀ ਖੁਸ਼ ਹੁੰਦੀਆਂ ਹੈ ਅਤੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਇੱਥੇ ਅਹ ਅਹ ਜਿਵੇਂ ਪੰਜਾਬੀ ਸਲਵਾਰ ਸੂਟ ਅਤੇ ਬਾਹਰ ਦੇ ਵੈਸਟਰਨ ਕਲਚਰ ਵਿੱਚ ਅ ਬਹੁਤ ਹੀ ਜ਼ਿਆਦਾ ਅਲੱਗ ਹੈਗਾ ਹੈ ਉੱਥੇ ਜਿਵੇਂ ਅਲੱਗ ਹੀ ਤਰ੍ਹਾਂ ਦੇ ਕੱਪੜੇ ਵਗੈਰਾ ਪਾਉਂਦੇ ਹਨ ਇਹ ਸਾਰੀਆਂ ਚੀਜ਼ਾਂ

ਹੋਰ ਵੀ ਬਹੁਤ ਸਾਰੇ ਸੱਭਿਆਚਾਰਕ ਹੈ ਜਿਵੇਂ ਆਪਾਂ ਕੁਛ ਕਹਿ ਸਕਦੇ ਹਾਂ ਲੋਕ ਨਾਚ ਇੱਥੇ ਇੱਥੇ ਦਾ ਭੰਗੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈਗਾ ਹੈ